ਹੈਲੋ ਸਤਿ ਸ਼੍ਰੀ ਅਕਾਲ ਜੀ ਕੌਣ ਜੀ ਕਿਆ ਹਾਲ ਹੈ ਜੀ ਮੈਂ ਤਾਂ ਠੀਕ ਹੈ ਤੁਸੀਂ ਦੱਸੋ ਕਿੰਨੇ ਚਿਰ ਬਾਅਦ ਫੋਨ ਕਰਿਆ ਮੈਨੂੰ ਤਾਂ ਲੱਗਦਾ ਤੁਸੀਂ ਟੇਲਰ ਕੋਈ ਹੋਰ ਲੱਭ ਲਿਆ ਹੋਣਾ ਮੈਨੂੰ ਲੱਗਦਾ ਹੋਰ ਕਿਆ ਤਾਂ ਹੀ ਤਾਂ ਯਾਦ ਨਹੀਂ ਆਉਂਦੀ ਅੱਛਾ ਜੀ ਮੈਂ ਕਿਹਾ ਕਿਤੇ ਭੁੱਲ ਏ ਗਏ ਹੋਰ ਦੱਸੋ ਅੱਛਾ ਜੀ ਅੱਛਾ ਜੀ ਠੀਕ ਹੈ ਮੈਨੂੰ ਤਾਂ ਲੱਗਿਆ ਕਿਤੇ ਤੁਸੀਂ ਟੇਲਰ ਚੇਂਜ ਕਰ ਲਿਆ ਤਾਂ ਹੀ ਨਹੀਂ ਆਏ ਕਿੰਨਾ ਚਿਰ ਹੋ ਗਿਆ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਹੈਗਾ ਟਾਈਮ ਦੇ ਦਿਓ ਨਾਪ ਤੁਸੀਂ ਦੱਸੋ ਵੀ ਉਹੀ ਨਾਪ ਹੈ ਕਿ ਚੇਂਜ ਹੋ ਗਏ ਮੋਟੇ ਹੋ ਗਏ ਠੀਕ ਹੈ ਠੀਕ ਹੈ ਦੱਸੋ ਜੀ ਲੈਂਥ ਕਿੰਨੀ ਹੈ ਤੁਹਾਡੀ ਅਤੇ ਆਪਣਾ ਘੇਰਾ ਹਾਂਜੀ ਓਕੇ ਅਤੇ ਆਪਣਾ ਕੀ ਕਹਿੰਦੇ ਹੁੰਦੇ ਹਾਂ ਕਮਰ ਛਾਤੀ ਹਿਪ ਵੱਧ ਗਿਆ ਹੈ ਨਾ ਨਾਪ ਮੋਟੇ ਹੋ ਗਏ ਲੱਗਦਾ ਅੱਧਾ ਅੱਧਾ ਇੰਚ ਵੱਧ ਗਿਆ ਹਾਂ ਲੱਗ ਰਿਹਾ ਠੀਕ ਹੈ ਠੀਕ ਹੈ ਅਤੇ ਗਲਾ ਡੀਪ ਰੱਖਣਾ ਮਤਲਬ ਕਿ ਆਹ ਮੋਹਰਲਾ ਗਲਾ ਕਿੰਨਾ ਰੱਖਣਾ ਸਾਢੇ ਛੇ ਅਤੇ ਪਿਛਲਾ ਫਿਰ ਆਪਾਂ ਤਿੰਨ ਕੁ ਬਹੁਤ ਹੈ ਤਿੰਨ ਚਾਰ ਕੁ ਚਾਰ ਅਤੇ ਗ ਆਪਣਾ ਬਾਹਾਂ ਲੰਬੀਆਂ ਰੱਖਣੀਆਂ ਪੰਦਰ੍ਹਾਂ ਇੰਚ ਲੰਬਾਈ ਅਤੇ ਮੂਹਰੀ ਕਿੰਨੀ ਹੈ ਜੀ ਸਾਢੇ ਪੰਜ ਅਤੇ ਸਲਵਾਰ ਚੱਲੋ ਕੋਈ ਗੱਲ ਨਹੀਂ ਉਹੀ ਨਾਪ ਹੋਣਾ ਤੁਸੀਂ ਐਂ ਕਰਿਓ ਮੇਰੇ ਕੋਲ ਲੈ ਆਇਓ ਮੇਰੇ ਕੋਲ ਲੈ ਆਇਓ ਮੈਂ ਬਣਾ ਦੂੰਗੀ ਓਕੇ ਜੀ ਓਕੇ